ਇਸ ਜ਼ਿਲ੍ਹੇੇ ਵਿੱਚ ਮੱਕੀ ਦੀ ਰੋਟੀ ਸਰ੍ਹੋਂ ਦਾ ਸਾਗ ਜਿਹੜਾ ਪ੍ਰਸਿੱਧ ਹੈ ਅਤੇ ਮ ਮਿੱਠੇ ਵਿੱਚ ਪੰਜੀਰੀ ਬਣਾਈ ਜਾਂਦੀ ਹੈ ਅਤੇ ਖੋਏ ਦੀਆਂ ਪਿੰਨੀਆਂ ਬਣਾਈ ਜਾਂਦੀਆਂ ਹਨ ਔਰ ਇਹਨੂੰ ਖੋਏ ਦੀ ਪਿੰਨੀਆਂ ਦੇ ਲਈ ਨੂੰ ਤਿਆਰ ਕਰਨ ਲਈ ਤਾਂ ਸਿਰਫ ਖੋਆ ਅਤੇ ਮਿੱਠਾ ਅਤੇ ਕੁਛ ਜਿਹੜੇ ਹੈਗੇ ਹੈ ਸੁੱਕੇ ਮੇਵਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਔਰ ਸਰ੍ਹੋਂ ਦੇ ਸਾਗ ਲਈ ਤਾਂ ਸਰ੍ਹੋਂ ਦਾ ਦੀ ਹੀ ਜ਼ਰੂਰਤ ਹੁੰਦੀ ਹੈ ਜਾਂ ਆਪਣੇ ਹਿਸਾਬ ਨਾਲ ਜੋ ਵੀ ਵਿੱਚ ਨਮਕ ਮਿਰਚ ਪਾਇਆ ਜਾਂਦਾ ਹੈ ਅਤੇ ਮੱਕੀ ਦੀ ਰੋਟੀ ਲਈ ਸਿਰਫ ਮੱਕੀ ਦਾ ਆਟਾ ਚਾਹੀਦਾ ਹੈ ਅਤੇ ਪੰਜੀਰੀ ਵਿੱਚ ਵੀ ਸੇਮ ਐਵੇਂ ਹੀ ਹੈ ਪੰਜੀਰੀ ਵਿੱਚ ਆਪਣਾ ਦੇਸੀ ਘਿਓ ਦੇ ਵਿੱਚ ਜਿਹੜਾ ਹੈਗਾ ਆਟਾ ਭੁੰਨ ਕੇ ਅਤੇ ਉਹਦੇ ਵਿੱਚ ਜੋ ਵੀ ਸਵਾਦ ਦੇ ਅਨੁਸਾਰ ਹੈਗੇ ਹੈ ਆਪਣੇ ਸੁੱਕੇ ਮੇਵੇ ਪਾਏ ਜਾਂਦੇ ਹਨ ਅਤੇ ਤਿਆਰ ਕੀਤੇ ਜਾਂਦੀ ਹੈ